ਹਾਂਜੀ ਸਾਡੇ ਪਿੰਡਾਂ ਦੇ ਵਿੱਚ ਕੀ ਆ ਤਿਉਹਾਰਾਂ 'ਤੇ ਸਮਾਗਮਾਂ ਦੇ ਮੌਕੇ 'ਤੇ ਨਾ ਜਿਹੜੀ ਕਿ ਵੱਖ ਵੱਖ ਤਰ੍ਹਾਂ ਦੇ ਡਾਂਸ ਜਿਵੇਂ ਗਿੱਧਾ ਭੰਗੜਾ ਈ ਆ ਪੰਜਾਬ ਦੇ ਵਿੱਚ ਤਾਂ ਅਤੇ ਭੰਗੜਾ ਤਾਂ ਘੱਟ ਪਰ ਗਿੱਧਾ ਜ਼ਰੂਰ ਪਾਉਂਦੀਆਂ ਸਾਡੇ ਲੇਡੀਜ਼ ਜਿਵੇਂ ਕਿਸੇ ਦੇ ਮੁੰਡਾ ਹੋਇਆ ਕਰਦੇ ਮੈਂ ਬਣਦੇ ਆ ਤਾਂ ਉਦੋਂ ਜਿਹੜੀਆਂ ਗਿੱਧਾ ਪਾ ਕੇ ਖੁਸ਼ੀ ਮਨਾਈ ਜਾਂਦੀ ਫਿਰ ਮੁੰਡੇ ਦੀ ਲੋਹੜੀ 'ਤੇ ਗਿੱਧਾ ਪਾ ਕੇ ਖੁਸ਼ੀ ਮਨਾਉਂਦੇ ਹੈਗੇ ਅਤੇ ਜਾਂ ਜਿਵੇਂ ਬਰਾਤ ਤੁਰਦੀ ਹੈ ਠੀਕ ਹੈ ਮੁੰਡੇ ਦਾ ਵਿਆਹ ਭਾਵੇਂ ਕੁੜੀ ਦਾ ਵਿਆਹ ਹੈਗਾ ਗਿੱਧੇ ਦੇ ਨਾਲ ਜਿਹੜਾ ਕੀ ਹੈਗਾ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਾਂਦਾ ਮਨ ਲਓ ਜੇ ਕਿਸੇ ਦੇ ਨਵੀਂ ਛੱਤ ਪਈ ਹੈਗੀ ਉੱਥੇ ਵੀ ਜੇਕਰ ਗਿੱਧੇ ਦੇ ਨਾਲ ਲੇਡੀਜ਼ ਇਕੱਠੀਆਂ ਹੋ ਕੇ ਗੀਤ ਗਾਉਂਦੀਆਂ ਨੇ ਗਿੱਧਾ ਪਾਉਂਦੀਆਂ ਨੇ ਅਤੇ ਪੂਰਾ ਖੁੱਲ੍ਹ ਕੇ ਇੰਜੋਇਮੈਂਟ ਕਰਦੀਆਂ ਹੈਗੀਆਂ ਅਤੇ ਉਹ ਆ ਆਪਦੇ ਮਨ ਦੇ ਜਿਹੜੇ ਵਲਵਲੇ ਕੱਢਦੀਆਂ ਹੈਗੀਆਂ ਉਹ ਜੇ ਮੌਕਿਆਂ 'ਤੇ ਜਿਵੇਂ ਹੁਣ ਸਾਡੇ ਪਿੱਛੇ ਛੱਤ ਪਈ ਸੀ ਅਤੇ ਐਂ ਥੋੜ੍ਹਾ ਵੀ ਇਕੱਲਾ ਵਿਆਹ 'ਤੇ ਇਕੱਲਾ ਗਿੱਧਾ ਪਾਉ ਕੁਛ ਵੀ ਡਾਂਸ ਕਰਦਾ ਹੈਗਾ ਤੋਲੀ ਬੁੜੀਆਂ ਨੇ ਇੱਥੇ ਪੂਰਾ ਗਿੱਧਾ ਪਾਇਆ ਪੂਰੇ ਐਂ ਖੁਸ਼ੀ ਦੇ ਗੀਤ ਗਾਏ ਉਹਨਾਂ ਨੇ ਤਾਂ ਇਹਦੇ ਕੀ ਜਿਹੜੇ ਕਿ ਡਾਂਸ ਹੈਗਾ ਸਾਡੇ ਜਿਹੜੇ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈਗਾ ਸਾਡੇ ਵੱਖ ਵੱਖ ਧਿਰਾਂ ਦੇ ਸਮਾਗਮਾਂ ਦੇ ਉੱਪਰ